ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਜਦੋਂ ਤੱਕ ਅਸੀਂ ਜਿਉਂਦੇ ਹਾਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਇੱਦਾਂ ਹੀ ਪੜ੍ਹਾਈ ਹੈ ਜਦ ਵੀ ਅਸੀਂ ਪੜ੍ਹਦੇ ਹੈ ਕਈ ਵਾਰ ਇੱਦਾਂ ਦੇ ਸ਼ਬਦ ਸਾਨੂੰ ਮਿਲਦੇ ਹੈ ਜੋ ਕਿ ਕਦੀ ਸੁਣੇ ਨਹੀਂ ਹੁੰਦੇ ਅਸੀਂ ਇਸ ਕਰਕੇ ਸਾਨੂੰ ਉਸ ਦਾ ਅਨੁਵਾਦ ਕਰਨਾ ਪੈਂਦਾ ਹੈ ਜਾਂ ਹਿੰਦੀ 'ਚ ਜਾਂ ਪੰਜਾਬੀ 'ਚ ਤਾਂ ਅਨੁਵਾਦ ਕਰਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਇੱਦਾਂ ਦਾ ਸ਼ਬਦ ਵੀ ਹੈ ਜੋ ਅਸੀਂ ਕਦੀ ਸੁਣਿਆ ਹੀ ਨਹੀਂ ਸੀ ਕੱਲ੍ਹ ਦਾ ਮੇਰਾ ਇਹੀ ਐਕਸਪੀਰੀਅੰਸ ਸੀਗਾ ਇੱਕ ਵਰਡ ਸੀਗਾ ਜਿਹਨੂੰ ਮੈਂ ਕਾਫੀ ਟਾਈਮ ਲੱਭਿਆ ਲੇਕਿਨ ਮਿਲਿਆ ਨਹੀਂ ਮੈਨੂੰ ਅਤੇ ਮੈਂ ਉਸ ਨੂੰ ਫਿਰ ਔਨਲਾਈਨ ਟ੍ਰਾਂਸਲੇਸ਼ਨ ਗੂਗਲ ਟ੍ਰਾਂਸਲੇਸ਼ਨ ਵਿੱਚ ਪਾਇਆ ਅਤੇ ਉਹਦਾ ਅਨੁਵਾਦ ਦੇਖਿਆ ਅਤੇ ਉਹ ਬਹੁਤ ਹੀ ਵਧੀਆ ਸੌਖਾ ਸ਼ਬਦ ਸੀਗਾ ਜਿਸ ਦੀ ਮੈਨੂੰ ਅੰਗਰੇਜ਼ੀ ਅੱਜ ਤੱਕ ਪਤਾ ਨਹੀਂ ਸੀਗੀ ਤਾਂ ਮੈਂ ਉਹਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਉਹਨੂੰ ਟ੍ਰਾਂਸਲੇਟ ਕਰਕੇ ਦੇਖਿਆ ਤਾਂ ਮੈਨੂੰ ਉਹਦਾ ਮਤਲਬ ਸਮਝ ਆਇਆ ਅੱਜ ਕੱਲ੍ਹ ਦੀ ਜ਼ਿੰਦਗੀ ਬਹੁਤ ਆਸਾਨ ਹੋ ਗਈ ਹੈ ਇੰਟਰਨੈੱਟ ਦੇ ਸਾਧਨਾਂ ਕਰਕੇ ਅਸੀਂ ਕਿਸੇ ਵੀ ਸ਼ਬਦ ਨੂੰ ਕਿਤੇ ਵੀ ਖੋਜ ਸਕਦੇ ਹੋ ਪੁਰਾਣੇ ਟਾਈਮਾਂ ਵਿੱਚ ਅਸੀਂ ਇੱਦਾਂ ਹੁੰਦਾ ਸੀ ਕਿ ਪੜ੍ਹਦੇ ਸੀਗੇ ਸਕੂਲਾਂ ਵਿੱਚ ਤਾਂ ਸਾਡੇ ਕੋਲ ਡਿਕ ਪੋਕਿਟ ਡਿਕਸ਼ਨਰੀ ਹੁੰਦੀ ਸੀ ਜੀ ਜਿਹਦੇ ਪੇਜ਼ ਬਾਏ ਪੇਜ਼ ਸਾਨੂੰ ਲੱਭਣਾ ਪੈਂਦਾ ਸੀ ਕਿ ਆਹ ਵਰਡ ਮਿਲ ਜਾਵੇ ਅਤੇ ਉਹਦੀ ਸਾਨੂੰ ਅਨੁਵਾਦ ਮਿਲ ਜਾਵੇ ਕਿ ਪੰਜਾਬੀ ਵਿੱਚ ਉਹਨੂੰ ਕਿਆ ਕਹਿੰਦੇ ਹੈ ਲੇਕਿਨ ਅੱਜ ਕੱਲ੍ਹ ਦੀ ਜ਼ਿੰਦਗੀ ਇੰਨੀ ਆਸਾਨ ਹੈ ਕਿ ਗੂਗਲ ਟ੍ਰਾਂਸਲੇਟ ਵਿੱਚ ਇੱਕ ਵਰਡ ਪਾਓ ਨਾਲ ਹੀ ਉਹਦੇ ਦਸ ਅਰਥ ਉਹ ਆਪ ਦੱਸ ਦਿੰਦਾ ਹੈ ਸੋ ਅਨੁਵਾਦ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ ਅਤੇ ਮੈਂ ਇਸ ਅਨੁਵਾਦ ਦਾ ਐਕਸਪੀਰੀਅੰਸ ਤਕਰੀਬਨ ਰੋਜ਼ ਹੀ ਲੈਨਾ